ਜਮੈਟੋ ਹੋਮ ਡਿਲੀਵਰੀ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਕੰਚਨ ਹੈ ਸਰ ਮੈਂ ਇੱਥੋਂ ਪਿੱਜ਼ਾ ਦਾ ਔਡਰ ਦਿੱਤਾ ਸੀ ਪਰ ਸਰ ਹੁਣ ਮੈਂ ਆਪਣਾ ਔਡਰ ਕੈਂਸਲ ਕਰਨਾ ਚਾਹੁੰਦੀ ਹਾਂ ਕਿਉਂਕਿ ਸਰ ਤੁਹਾਡੇ ਕੋਲ ਭੁਗਤਾਨ ਵਾਸਤੇ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈ ਪਰ ਸਰ ਕਿਸੇ ਪਰਸਨਲ ਰੀਜਨਸ ਦਾ ਕਰਕੇ ਮੇਰਾ ਬੈਂਕ ਅਕਾਊਂਟ ਨਹੀਂ ਹੈ ਔਰ ਸਰ ਮੈਨੂੰ ਔਨਲਾਈਨ ਪੇ ਕਰਨਾ ਥੋੜ੍ਹਾ ਰਿਸਕੀ ਲੱਗਦਾ ਕਿਉਂਕਿ ਮੈਨੂੰ ਲੱਗਦਾ ਕਿ ਔਨਲਾਈਨ ਪੇਮੈਂਟ ਕਰਨ ਨਾਲ ਬਹੁਤ ਸਾਰੇ ਫਰੋਡਸ ਹੁੰਦੇ ਆ ਪਿਛਲੇ ਹਫ਼ਤੇ ਮੈਂ ਇਹਨਾਂ ਚੀਜ਼ਾਂ ਨੂੰ ਐਕਸਪੀਰੀਅੰਸ ਕਰ ਚੁੱਕੀ ਹਾਂ ਸੋ ਸਰ ਹੁਣ ਮੈਂ ਬਿਲਕੁਲ ਯਕੀਨ ਨਹੀਂ ਰੱਖਦੀ ਔਨਲਾਈਨ ਪੇ ਕਰਨ ਵਿੱਚ ਇਸ ਕਰਕੇ ਮੈਂ ਆਪ ਜੀ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਸੀ ਓ ਡੀ ਦੀ ਆਪਸ਼ਨ ਜ਼ਰੂਰ ਰੱਖੋ ਤਾਂ ਜੋ ਕਸਟਮਰਸ ਨੂੰ ਭੁਗਤਾਨ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਐਂਡ ਹੁਣ ਮੈਂ ਆਪਣਾ ਅ ਔਡਰ ਕੈਂਸਲ ਕਰਨਾ ਚਾਹੁੰਦੀ ਆਂ ਕਿਰਪਾ ਕਰਕੇ ਮੇਰਾ ਔਡਰ ਕੈਂਸਲ ਕਰ ਦਿੱਤਾ ਜਾਵੇ ਅਤੇ ਇੱਕ ਵਾਰ ਫਿਰ ਰਿਕੁਐਸਟ ਕਰਦੀ ਹਾਂ ਕਿਰਪਾ ਕਰਕੇ ਸੀ ਓ ਡੀ ਦੀ ਆਪਸ਼ਨ ਜ਼ਰੂਰ ਰੱਖੋ ਭੁਗਤਾਨ ਲਈ